ਸਤਿ ਸ਼੍ਰੀ ਅਕਾਲ ਜੀ ਮੈਂ ਭਾਵਿਕਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਜਿਵੇਂ ਕਿ ਤੁਸੀ ਵੀ ਜਾਣਦੇ ਹੋ ਕਿ ਅੱਜ ਕੱਲ੍ਹ ਸਾਰਾ ਹੀ ਕੰਮ ਔਨਲਾਈਨ ਹੋ ਰਿਹਾ ਹੈ ਇਸ ਲਈ ਮੈਨੂੰ ਵੀ ਆਪਣੇ ਕੰਮ ਕਰਨ ਦੇ ਲਈ ਹੈੱਡਫੋਨ ਦੀ ਲੋੜ ਸੀ ਮੈਂ ਆਪਣੀਆਂ ਦੋ ਚਾਰ ਸਹੇਲੀਆਂ ਕੋਲੋਂ ਸਲਾਹ ਲਈ ਅਤੇ ਉਹਨਾਂ ਨੇ ਮੈਨੂੰ ਤੁਹਾਡੀ ਸਾਈਟ ਬਾਰੇ ਦੱਸਿਆ ਤਾਂ ਮੈਂ ਉਹਨਾਂ ਦੀ ਸਲਾਹ ਮੰਨ ਕੇ ਤੁਹਾਡੀ ਸਾਈਟ ਤੋਂ ਔਨਲਾਈਨ ਹੈੱਡਫੋਨਸ ਔਡਰ ਕੀਤੇ ਸੀ ਜੋ ਕਿ ਸਿਰਫ ਤਿੰਨ ਚਾਰ ਦਿਨ ਹੀ ਸਹੀ ਤਰੀਕੇ ਨਾਲ ਚੱਲੇ ਅਤੇ ਬਾਅਦ ਵਿੱਚ ਇਸ ਦਾ ਇੱਕ ਸਾਈਡ ਵਾਲਾ ਹੈੱਡਫੋਨ ਵੀ ਖਰਾਬ ਹੋ ਗਿਆ ਅਤੇ ਇਸ ਦੀ ਸਾਊਂਡ ਕੁਆਲਿਟੀ ਵੀ ਬਹੁਤ ਖਰਾਬ ਹੋ ਗਈ ਹੈ ਅਤੇ ਮੈਂ ਤੁਹਾਨੂੰ ਇਹ ਦੁਰਖਿਆਸ ਹੈ ਕਿ ਜਾਂ ਤਾਂ ਤੁਸੀ ਮੈਨੂੰ ਇਹ ਹੈੱਡਫੋਨ ਦੀ ਥਾਂ 'ਤੇ ਦੂਸਰੇ ਹੈੱਡਫੋਨ ਦੇਵੋ ਜਾਂ ਮੇਰੇ ਪੈਸੇ ਵਾਪਿਸ ਕਰ ਦਿਓ ਜੋ ਮੈਂ ਕਿਸੇ ਹੋਰ ਸਾਈਟ ਤੋਂ ਹੈੱਡਫੋਨ ਮੰਗਵਾ ਸਕਾਂ ਅਤੇ ਆਪਣਾ ਕੰਮ ਬਿਨ੍ਹਾ ਕਿਸੇ ਰੁਕਾਵਟ ਤੋਂ ਕਰ ਸਕਾਂ ਧੰਨਵਾਦ